ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਸਿੰਧੂ ਟਰਾਂਸਪੋਰਟ ਤੋਂ ਬੋਲ ਰਹੇ ਹੋ ਵੀਰੇ ਮੈਂ ਤੁਹਾਡੀ ਇੱਕ ਕੈਬ ਬੁੱਕ ਕੀਤੀ ਸੀਗੀ ਅਤੇ ਮੈਂ ਇੱਥੇ ਖੜ੍ਹੀ ਹਾਂ ਝੂੰਬੇ ਪਿੰਡ ਅਤੇ ਤੁਹਾਡਾ ਡਰਾਈਵਰ ਹਾਲੇ ਤੱਕ ਆਇਆ ਨਹੀਂ ਹੈਗਾ ਅਤੇ ਇੱਥੇ ਸੁੰਨਸਾਨ ਜਗ੍ਹਾ 'ਤੇ ਖੜ੍ਹਨਾ ਮੁਸ਼ਕਿਲ ਮੁਸ਼ਕਿਲ ਆ ਵੀਰਾ ਅਤੇ ਮਾੜਾ ਜਿਹਾ ਡਰਾਈਵਰ ਨੂੰ ਨਾ ਛੇਤੀ ਭੇਜ ਦਿਓ ਮੈਂ ਘਰ ਵੀ ਜਾਣਾ ਜਲਦੀ ਘਰੋਂ ਫੋਨ ਆਈ ਜਾਂਦੇ ਹੈਗੇ ਨਾਲੇ ਰਿਸ਼ਤੇਦਾਰ ਆਏ ਹੋਏ ਹੈਗੇ ਅਤੇ ਇੱਥੇ ਖੜ੍ਹਨਾ ਬਹੁਤ ਮੁਸ਼ਕਿਲ ਆ ਵੀਰੇ ਸੁੰਨਸਾਨ ਜਿਹੀ ਜਗ੍ਹਾ ਹੈਗੀ ਅਤੇ ਤੁਹਾਡਾ ਡਰਾਈਵਰ ਪਹੁੰਚਿਆ ਨਹੀਂ ਵੀਰੇ ਅਤੇ ਮੈਨੂੰ ਘਰ ਜਾਣ ਦੀ ਕਾਹਲੀ ਹੈਗੀ ਅਤੇ ਮੈਂ ਤੁਹਾਨੂੰ ਪਹਿਲਾਂ ਹੀ ਪੇਮੈਂਟ ਔਨਲਾਈਨ ਕਰਤੀ ਸੀਗੀ ਵੀਰੇ ਅਤੇ ਤੁਸੀਂ ਮੈਨੂੰ ਨਾ ਹੁਣ ਪੇਮੈਂਟ ਮੇਰੀ ਵਾਪਸ ਕਰ ਦਿਓ ਤੁਹਾਡਾ ਡਰਾਈਵਰ ਆਇਆ ਨਹੀਂ ਹੈਗਾ ਮੈਂ ਘਰ ਫੋਨ ਕਰਤਾ ਅਤੇ ਉਹ ਮੈਨੂੰ ਲੈਣ ਆਈ ਜਾਂਦੇ ਹੈਗੇ ਠੀਕ ਹੈ